ਜੇਕਰ ਪੰਜਾਬ ਖੇਤਰ ਦੇ ਵਿੱਚ ਕਾਰੋਬਾਰੀ ਖੇਤਰ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਪੰਜਾਬ ਦੇ ਵਿੱਚ ਮੈਨੇਜਮੈਂਟ ਦੀ ਨੌਕਰੀਆਂ ਨਿਕਲੀਆਂ ਹਨ ਅਤੇ ਪੰਜਾਬ ਦੇ ਲੁਧਿਆਣਾ ਅਤੇ ਜਲੰਧਰ ਲੁਧਿਆਣਾ ਪੰਜਾਬ ਦਾ ਮੈਨਚੈਸਟਰ ਕਿਹਾ ਜਾਂਦਾ ਹੈ ਅਤੇ ਜਲੰਧਰ ਆਪਣੇ ਪੂਰੇ ਭਾਰਤ ਦਾ ਸਪੋਰਟਸ ਹਬ ਕਿਹਾ ਜਾਂਦਾ ਹੈ ਜਿੱਥੇ ਕਿ ਸਪੋਰਟਸ ਦੀ ਸਾਰੀ ਚੀਜ਼ਾਂ ਮਿਲਦੀਆਂ ਹਨ ਅਤੇ ਲੁਧਿਆਣੇ ਵਿੱਚ ਸਾਰਾ ਉੱਨ ਦਾ ਸਮਾਨ ਕੱਪੜਿਆਂ ਦਾ ਸਾਰਾ ਸਮਾਨ ਮਿਲਦਾ ਹੈ ਜੇਕਰ ਗੱਲ ਕਰੀਏ ਆਪਾਂ ਇਹਨਾਂ ਵੱਡੀਆਂ ਇੰਡਸਟਰੀਆਂ ਨੂੰ ਮੈਨੇਜ ਕਰਨ ਲਈ ਬਹੁਤ ਸਾਰੇ ਮੈਨੇਜਮੈਂਟ ਦੇ ਲੋਕਾਂ ਦੀ ਲੋੜ ਪੈਂਦੀ ਹੈ ਅਤੇ ਇਹਨਾਂ ਦੀ ਭਰਤੀ ਇੱਕ ਬਹੁਤ ਸ ਵਧੀਆ ਤਰੀਕੇ ਨਾਲ ਕੀਤੀ ਜਾਂਦੀ ਹੈ ਕਈ ਲੋਕ ਅਖ਼ਬਾਰ 'ਚ ਇਸ਼ਤਿਹਾਰ ਦਿੰਦੇ ਨੇ ਅਤੇ ਕਈ ਲੋਕ ਅਖ਼ਬਾਰ ਦੇ ਇਸ਼ਤਿਹਾਰ ਦੇ ਬਜਾਇ ਖੁੱਲ੍ਹਮ ਖੁੱਲ੍ਹਾ ਡਾਇਰੈਕਟ ਨੌਕਰੀਆਂ ਕੱਢਦੇ ਨੇ ਅਤੇ ਲੋਕ ਡਾਇਰੈਕਟ ਉਹਨਾਂ ਨੂੰ ਉਹਨਾਂ ਦੀ ਵੈੱਬਸਾਈਟ ਜਾਂ ਕੰਪਨੀ ਦੀ ਵੈੱਬਸਾਈਟ ਦੇ ਰਾਹੀਂ ਉਹ ਉਹਨਾਂ ਨੂੰ ਅਪਲਾਈ ਕਰਕੇ ਅੱਗੇ ਵੱਧ ਸਕਦੇ ਨੇ ਜੇਕਰ ਆਪਾਂ ਇਹਨਾਂ ਦੀ ਪ੍ਰਕਿਰਿਆ ਦੀ ਗੱਲ ਕਰੀਏ ਤਾਂ ਪਹਿਲਾਂ ਤਾਂ ਇਹ ਇਗਜ਼ਾਮ ਵੀ ਲੈ ਸਕਦੇ ਨੇ ਅਤੇ ਪਹਿਲਾਂ ਇਹ ਸਿੱਧਾ ਇੰਟਰਵਿਊ ਵੀ ਲੈ ਸਕਦੇ ਨੇ ਇਹ ਕੰਪਨੀ ਟੂ ਕੰਪਨੀ ਡਿਪੈਂਡ ਕਰਦਾ ਹੈ ਪੰਜਾਬ ਦੇ ਵਿੱਚ ਜ਼ਿਆਦਾਤਰ ਡਾਇਰੈਕਟ ਰਿਕਰੂਟਮੈਂਟ ਹੀ ਮੰਨੀ ਜਾਂਦੀ ਹੈ